ਅੱਜ ਕੱਲ ਹਰ ਇੱਕ ਭਾਸ਼ਾ ਵਿੱਚ ਉਪਲਬਧ ਹਨ ਸਥਾ ਹਰ ਇੱਕ ਸਥਾਨਕ ਭਾਸ਼ਾ ਵਿੱਚ ਨਿਊਜ਼ ਚੈਨਲ ਹਨ ਮੇਰੀ ਸ ਸਥਾਨਕ ਭਾਸ਼ਾ ਜਿਵੇਂ ਕਿ ਪੰਜਾਬੀ ਹੈ ਤਾਂ ਮੈਂ ਪੰਜਾਬੀ ਵਿੱਚ ਹੀ ਖ ਖਬਰਾਂ ਦੇਖਣਾ ਪਸੰਦ ਕਰਦਾ ਹਾਂ ਅੱਜ ਕੱਲ ਹਰ ਬੰਦੇ ਦੀ ਭਾਸ਼ਾ ਅਲੱਗ ਅਲੱਗ ਹੈ ਜਿਵੇਂ ਕਿ ਕਿਸੇ ਨੂੰ ਹਿੰਦੀ ਪਸੰਦ ਹੈ ਕਿਸੇ ਨੂੰ ਅੰਗਰੇਜ਼ੀ ਪਸੰਦ ਹੈ ਜਾਂ ਕਿਸੇ ਨੂੰ ਤੇਲਗੂ ਉਹ ਆਪਣੀ ਆਪਣੀ ਭਾਸ਼ਾ ਵਿੱਚ ਹੀ ਚੈਨਲ ਦੇ ਖਬਰਾਂ ਦੇਖਣਾ ਪਸੰਦ ਕਰੇਗਾ ਕਿਉਂਕਿ ਇਸ ਨਾਲੋਂ ਉਸ ਨੂੰ ਜਿਆ ਇੱਕ ਤਾਂ ਖਬਰ ਦੀ ਛੇਤੀ ਸਮਝ ਆਵੇਗੀ ਅਤੇ ਦੂਜਾ ਉਸਨੂੰ ਦੂਸਰੀ ਲੈਂਗੁਏਜ ਨੂੰ ਸਮਝਣ ਦੇ ਵਿੱਚ ਦਿੱਕਤ ਨਹੀਂ ਪਰੇਸ਼ਾਨੀ ਹੋਵੇਗੀ ਸੋ ਹਰ ਇੱਕ ਬੰਦੇ ਦੀ ਆਪਣੀ ਆਪਣੀ ਸੋਚ ਵੀ ਹੈ ਅਤੇ ਆਪਣੀ ਆਪਣੀ ਭਾ ਭਾਸ਼ਾ ਦੀ ਪਸੰਦ ਵੀ ਹੈ ਜਿਵੇਂ ਪੰਜਾਬ ਵਿੱਚ ਜ਼ਿਆਦਾਤਰ ਲੋਕ ਪੰਜਾਬੀ ਭਾਸ਼ਾ ਦੇ ਚੈਨਲ ਹੀ ਦੇਖਣਾ ਪਸੰਦ ਕਰਦੇ ਆ ਜਿਨ੍ਹਾਂ ਵਿੱਚੋਂ ਇੱਕ ਹੈ ਪੀ ਟੀ ਸੀ ਪੰਜਾਬੀ ਨਿਊਜ਼ ਅਤੇ ਨਿਊਜ਼ ਏਟੀਨ ਪੰਜਾਬੀ ਇਹਨਾਂ ਦੀਆਂ ਖਬਰਾਂ ਦੇਖਣ ਨਾਲ ਸਾਨੂੰ ਇੱਕ ਤਾਂ ਗਿਆਨ ਵਿੱਚ ਵਾਧਾ ਹੁੰਦਾ ਅਤੇ ਇੱਕ ਇਹਨਾਂ ਦੀਆਂ ਖਬਰਾਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਹਨ ਇਹ ਉਹ ਚੀਜ਼ਾਂ ਦਿਖਾਉਂਦੇ ਹਨ ਜੋ ਕਿ ਅੱਜ ਕੱਲ ਸਮਾਜ ਵਿੱਚ ਚੱਲ ਰਹੀਆਂ ਹਨ ਅਤੇ ਸ ਨਾ ਕਿ ਆਪਣੇ ਕੋਲੋਂ ਕੁਝ ਫਾਲਤੂ ਜੋੜ ਕੇ ਦਿਖਾਉਂਦੇ ਹਨ ਸੋ ਧੰਨਵਾਦ ਜੀ